ਬਹੁਤ ਸਾਰੇ ਲੋਕ ਕਲਾ ਵਿੱਚ ਸ਼ਿਲਪਕਾਰੀ ਜਾਂ ਹੋਰਨਾਂ ਕਿੱਤਿਆਂ ਵਿੱਚ ਲੋਕ ਲੱਗੇ ਹੋਏ ਹਨ ਕਈ ਲੋਕ ਤਾਂ ਆਪਣੇ ਪੁਰਾਣੇ ਜਿਵੇਂ ਕਿ ਪੁਰਾਣੇ ਪੇਰੈਂਟਸ ਵਾਲਾ ਕੰਮ ਕਰਦੇ ਹਨ ਜਿਵੇਂ ਤਰ ਭਾਂਡੇ ਬਣਾਉਂਦੇ ਨੇ ਉਹ ਪੁਰਾਣੇ ਘੁੰਮਿਆਰਾਂ ਦੇ ਨਿਆਣੇ ਅੱਗੇ ਕੰਮ ਕਰਦੇ ਹਨ ਉਹ ਭਾਂਡੇ ਬਣਾਉਂਦੇ ਹਨ ਜਾਂ ਤਰਖਾਣਾਂ ਦੇ ਬੱਚੇ ਅੱਗੇ ਕੰਮ ਕਰਦੇ ਹਨ ਲੱਕੜ ਦਾ ਕੰਮ ਕਰਦੇ ਹਨ ਅੱਜ ਕੱਲ੍ਹ ਲੋਕ ਦਾ ਕਿੱਤਾ ਹੁਣ ਸ਼ਿਲਪਕਾਰੀ ਜਾਂ ਲੋਕ ਕਲਾ ਚੇਂਜ ਹੋ ਗਈ ਹੁਣ ਲੋਕ ਭਾਂਡਿਆਂ ਦੀ ਜਗ੍ਹਾ 'ਤੇ ਗਮਲੇ ਘਰ ਦੀ ਡੈਕੋਰੇਸ਼ਨ ਲਈ ਸਮਾਨ ਹੁਣ ਬਹੁਤ ਸੋਹਣੀਆਂ ਸੋਹਣੀਆਂ ਸੀਨਰੀਆਂ ਘਰ ਦੇ ਅਲੱਗ ਅਲੱਗ ਤਰ੍ਹਾਂ ਦੇ ਗਮਲੇ ਤੁਲਸੀ ਦੇ ਬੂਟੇ ਈਵਨ ਵਾਲ ਹੈਂਗਿੰਗ ਵੀ ਮਿੱਟੀ ਦੇ ਬਣਨ ਲੱਗ ਗਏ ਘੁੰਮਿਆਰ ਹੁਣ ਪਹਿਲਾਂ ਵਾਂਗ ਕੰਮ ਨਹੀਂ ਕਰਦੇ ਕਿ ਘੜੇ ਹੀ ਬਣਾਉਣੇ ਆ ਸਿਰਫ ਹੁਣ ਜਾਂ ਗਮਲੇ ਹੀ ਬਣਾਉਣੇ ਆ ਹੈ ਨਾ ਹੁਣ ਹਰ ਚੀਜ਼ ਮਿੱਟੀ ਦੇ ਤਵੇ ਮਿੱਟੀ ਦੀਆਂ ਕੜਾਹੀਆਂ ਮਿੱਟੀ ਦੇ ਪਤੀਲੇ ਜਾਂ ਗਮਲੇ ਬਹੁਤ ਸੋਹਣੇ ਸੋਹਣੇ ਲੈਂਪ ਵੀ ਬਣਨ ਲੱਗ ਗਏ ਮਿੱਟੀ ਦੇ ਇਸ ਤਰ੍ਹਾਂ ਲੋਕ ਬਹੁਤ ਅੱਜ ਕੱਲ੍ਹ ਸ਼ਿਲਪਕਾਰੀ ਵਿੱਚ ਅਲੱਗ ਹੁਨਰ ਆ ਗਿਆ ਤਰਖਾਣ ਵੀ ਐਵੇਂ ਹੈ ਕਿ ਇਕੱਲੇ ਇੱਥੇ ਦਰਵਾਜ਼ਿਆਂ ਤੱਕ ਨਹੀਂ ਸੀਮਿਤ ਰਹਿ ਗਏ ਹੁਣ ਲੋਕ ਬੈੱਡ ਸੋਫੇ ਫਰਨੀਚਰ ਅਲੱਗ ਅਲੱਗ ਤਰ੍ਹਾਂ ਦੀਆਂ ਕੁਰਸੀਆਂ ਅਲੱਗ ਅਲੱਗ ਡਿਜ਼ਾਈਨ ਦੇ ਬੈੱਡ ਹੈ ਨਾ ਉੱਤੇ ਮੰਜੇ ਪਹਿਲਾਂ ਤਾਂ ਮੰਜੇ ਹੀ ਬਣਦੇ ਸਨ ਹੁਣ ਅਲੱਗ ਤਰ੍ਹਾਂ ਦੀਆਂ ਹੋਰ ਚੀਜ਼ਾਂ ਹੋਰ ਘਰ 'ਚ ਸਜਾਉਣ ਦਾ ਸਮਾਨ ਲੱਕੜ ਦਾ ਈਵਨ ਕੰਧਾਂ 'ਤੇ ਡੈਕੋਰੇਟ ਕਰਨ ਲਈ ਸ਼ੀਸ਼ਿਆਂ ਦੇ ਬੋਟਲ ਲੱਕੜ ਦੇ ਤਰਖਾਣ ਆਦਿ ਬਣਾਉਣ ਲੱਗ ਗਏ ਹੁਣ ਬਹੁਤ ਸਾਰੇ ਲੋਕ ਨੇ ਜਿਹੜੇ ਅੱਜ ਵੀ ਲੋਕ ਕਲਾ ਵਿੱਚ ਲੱਗੇ ਹੋਏ ਨੇ ਸ਼ਿਲਪਕਾਰੀਆਂ ਹੁਣ ਲੋਕਾਂ ਨੂੰ ਜ਼ਿਆਦਾ ਇਹ ਹੋ ਗਿਆ ਕਿਉਂਕਿ ਇਹਨਾਂ 'ਚ ਕਮਾਈ ਵੀ ਚੰਗੀ ਹੁੰਦੀ ਆ ਪਹਿਲਾਂ ਦੀ ਤਰ੍ਹਾਂ ਨਹੀਂ ਕਿ ਘੱਟ ਕਮਾਈ ਵਾਲਿਆਂ ਨੇ ਅੱਜ ਕੱਲ੍ਹ ਲੋਕਾਂ ਨੂੰ ਲੋਕ ਕਲਾ ਕਨੀ ਜ਼ਿਆਦਾ ਆਕਰਸ਼ਿਤ ਹੋ ਗਏ ਹੁਣ ਇਹਦਾ ਜ਼ਿਆਦਾ ਮਸ਼ਹੂਰ ਹੋ ਗਏ ਕਿਉਂਕਿ ਇੰਟਰਨੈਟ ਸਰਵਿਸ ਹੈਗੀ ਆ ਲੋਕ ਆਪਣੇ ਹੁਨਰ ਨੂੰ ਦਿਖਾ ਸਕਦੇ ਨੇ ਸਾਰੀ ਦੁਨੀਆਂ 'ਚ ਫੈਲਾ ਸਕਦੇ ਹਨ